ਹਾਂਜੀ ਐਕਸਪੋ ਦੀ ਗੱਲ ਕਰੀਏ ਤਾਂ ਮੈਂ ਹੁਣੇ ਜਿਹੜਾ ਸਿਕਾਰਾਂ ਦਾ ਐਕਸਪੋ ਲੱਗਿਆ ਸੀ ਦਿੱਲੀ ਦੇ ਵਿੱਚ ਬਹੁਤ ਵੱਡਾ ਉਹਦੇ ਦੌਰੇ 'ਤੇ ਗਈ ਸੀ ਸਾਡੇ ਕੋਲੇਜ ਵੱਲੋਂ ਮਕੈਨਿਕਲ ਵਿਭਾਗ ਦੇ ਨਾਲ ਸਾਨੂੰ ਜਾਣ ਦਾ ਮੌਕਾ ਮਿਲਿਆ ਅਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਐਕਸਪੋਜ ਨੇ ਬਹੁਤ ਜਿਹੜੇ ਫਾਇਦੇਮੰਦ ਨੇ ਤਾਂ ਜੋ ਜਿਹੜੇ ਆਉਣ ਵਾਲੀਆਂ ਗੱਡੀਆਂ ਜਾਂ ਜਿਹੜੀਆਂ ਕਾਰਾਂ ਸਾਨੂੰ ਅੱਗੇ ਹਲੇ ਆਉਣ 'ਚ ਮਿਲਣੀਆਂ ਨੇ ਉਹਨਾਂ ਦੀਆਂ ਜਿਹੜੀਆਂ ਕੀਮਤਾਂ ਬਾਰੇ ਉਹਨਾਂ ਦੀਆਂ ਫੈਸਿਲਿਟੀਜ਼ ਬਾਰੇ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਸਹੂਲਤਾਂ ਨੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ ਅਤੇ ਮੇਰਾ ਅਨੁਭਵ ਬਹੁਤ ਵਧੀਆ ਰਿਹਾ ਜੀ ਬਹੁਤ ਸਾਰੀਆਂ ਉੱਥੇ ਜਾ ਕੇ ਦੇਖਣ ਦਾ ਮਿਲਿਆ ਮੌਕਾ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਅਸੀਂ ਲੈ ਵੀ ਨਹੀਂ ਸਕਦੇ ਕੀਮਤਾਂ ਬਹੁਤ ਜਿਆਦੇ ਨੇ ਪਰ ਉਹਨਾਂ ਦੀਆਂ ਸਾਨੂੰ ਜਿਹੜੀਆਂ ਉਹਨਾਂ ਦੀਆਂ ਸਹੂਲਤਾਂ ਨੇ ਜਾਂ ਉਹਨਾਂ ਨੂੰ ਜਿਹੜੀਆਂ ਬਹੁਤ ਇਮਪਰੂਵਮੈਂਟਸ ਕੀਤੀਆਂ ਉਹਨਾਂ ਬਾਰੇ ਸਾਨੂੰ ਪਤਾ ਲੱਗਿਆ ਉੱਥੇ ਜਾ ਕੇ ਨਹੀਂ ਤਾਂ ਮੈਂ ਜਿਹੜੀਆਂ ਕਾਰਾਂ ਨੇ ਆਪਾਂ ਖਰੀਦ ਨਹੀਂ ਸਕਦੇ ਉਹਨੂੰ ਆਪਾਂ ਨੂੰ ਦੇਖਣ ਦਾ ਮੌਕਾ ਵੀ ਨਹੀਂ ਮਿਲਦਾ ਅਤੇ ਦੂਜੀ ਗੱਲ ਆ ਵੀ ਜੇ ਸਾਨੂੰ ਦੇਖਣੀਆਂ ਵੀ ਆ ਤਾਂ ਸਾਨੂੰ ਅੱਡ ਅੱਡ ਥਾਵਾਂ 'ਤੇ ਜਾ ਕੇ ਦੇਖਣਾ ਪਊ ਜਿੰਨਾਂ ਸਮਾਂ ਬੜਾ ਲੱਗਦਾ ਅਤੇ ਅਸੀਂ ਬਹੁਤ ਵਾਰੀ ਤੀ ਜਾਣਾ ਵੀ ਨਹੀਂ ਪਸੰਦ ਕਰਦੇ ਤੇ ਇੱਕੋ ਥਾਂ 'ਤੇ ਜਾ ਕੇ ਸਾਨੂੰ ਇੰਨਾਂ ਵੱਡਾ ਜਿਹੜਾ ਸਾਰਾ ਕੁਛ ਦੇਖਣ ਦਾ ਮੌਕਾ ਮਿਲਿਆ ਉਹ ਮੇਰੇ ਲਈ ਬੜਾ ਦਿਲਚਸਪ ਸੀ ਅਤੇ ਮੈਨੂੰ ਬੜੀ ਸਾਰੀ ਉਹਦੇ ਨਾਲ ਜਿਹੜੀ ਹੈ ਜਾਣਕਾਰੀ ਮਿਲੀ ਅੱਡ ਅੱਡ ਗੱਡੀਆਂ ਨੂੰ ਦੇਖਣ ਦਾ ਅਤੇ ਜਾਨਣ ਦਾ ਮੌਕਾ ਮਿਲਿਆ ਸੋ ਇਹ ਬੜਾ ਵਧੀਆ ਅਨੁਭਵ ਸੀਗਾ ਮੇਰਾ